ਜੇਕਰ ਗੱਲ ਕਰੀਏ ਮੇਰੇ ਖਿਆਲਾਂ ਦੀ ਮੇਰੇ ਖਿਆਲ ਦੇ ਹਿਸਾਬ ਨਾਲ ਸਾਡੇ ਸ਼ਹਿਰਾਂ ਵਿੱਚ ਪਿਛਲੇ ਸਾਲਾਂ ਵਿੱਚ ਬਹੁਤ ਹੀ ਜ਼ਿਆਦਾ ਸੈਰ ਸਪਾਟਾ ਘਟਿਆ ਹੈ ਜਿਵੇਂ ਕਿ ਕੋਵਿਡ ਦੇ ਦੌਰਾਨ ਕੋਵਿਡ ਨਾਈਨਟੀਨ ਦੇ ਦੌਰਾਨ ਮਹਾਂਮਾਰੀਆਂ ਦੇ ਫੈਲਣ ਕਰਕੇ ਲੋਕਾਂ ਨੇ ਆਪਣੇ ਘਰੋਂ ਨਿਕਲਣਾ ਹੀ ਬੰਦ ਕਰ ਦਿੱਤਾ ਸੀ ਅਤੇ ਗੌਰਮੈਂਟ ਵੱਲੋਂ ਵੀ ਸਖ਼ਤ ਹਿਦਾਇਤਾਂ ਸੀਗਾ ਕਿ ਆਪਣੇ ਘਰ ਤੋਂ ਬਾਹਰ ਕੋਈ ਵੀ ਨਾ ਨਿਕਲੇ ਜਿਹੜਾ ਵੀ ਨਿਕਲੇਗਾ ਉਹਨੂੰ ਪਹਿਲਾਂ ਗੌਰਮੈਂਟ ਕੋਲੋਂ ਪਰਮਿਸ਼ਨ ਲੈਣ ਦੀ ਜ਼ਰੂਰਤ ਹੁੰਦੀ ਸੀਗਾ ਹਾਂ ਅਗਰ ਗੱਲ ਕਰੀਏ ਹੁਣ ਦੀ ਕੋਵਿਡ ਤੋਂ ਬਾਅਦ 'ਚੋਂ ਨਿਕਲੇ ਚਾਰ ਪੰਜ ਸਾਲਾਂ ਬਾਅਦ ਕਾਫੀ ਜ਼ਿਆਦਾ ਸੈਰ ਸਪਾਟੇ ਵਿੱਚ ਵਧਾਓ ਮਿਲ ਰਿਹਾ ਹੈ ਜਿਹਦੇ ਕਾਰਨ ਟੂਰਿਜ਼ਮ ਵੀ ਵੱਧ ਰਿਹਾ ਹੈ ਸਾਡੇ ਅੰਮ੍ਰਿਤਸਰ ਦੀ ਗੱਲ ਕਰੀਏ ਸਾਡੇ ਅੰਮ੍ਰਿਤਸਰ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਪਹਿਲਾਂ ਵੀ ਆਉਂਦੇ ਹਨ ਅਤੇ ਹੁਣ ਵੀ ਆਉਣਾ ਸ਼ੁਰੂ ਹੋ ਗਏ ਹਨ ਸਾਡੇ ਅੰਮ੍ਰਿਤਸਰ ਦੀ ਇਤਿਹਾਸਿਕਤਾ ਸਥਾਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਹਰਿਮੰਦਰ ਸਾਹਿਬ ਦੇਖਣ ਲਈ ਪਹਿਲਾਂ ਵੀ ਤਰ੍ਹਾਂ ਤਰ੍ਹਾਂ ਦੇ ਲੋਕ ਅਤੇ ਦੂਰੋਂ ਦੂਰੋਂ ਦੀ ਲੋਕ ਆਉਂਦੇ ਹਨ ਅਤੇ ਹੁਣ ਵੀ ਸ਼ੁਰੂ ਹੋ ਗਏ ਹਨ ਪਿਛਲੇ ਕਈ ਸਾਲਾਂ ਵਿੱਚ ਪਿਛਲੇ ਕਈ ਸਾਲਾਂ ਵਿੱਚ ਸੈਰ ਸਪਾਟਾ ਘਟਿਆ ਵੀ ਹੈ ਅਤੇ ਵਧੀਆ ਵੀ ਹੈ ਕੋਵਿਡ ਦੇ ਦੌਰਾਨ ਘੱਟਣ ਦਾ ਬਹੁਤ ਜ਼ਿਆਦਾ ਕਾਰਨ ਸਨ ਤਾਂ ਕੀ ਅ ਮਹਾਂਮਾਰੀ ਜੋ ਹੈ ਆਪਸੀ ਮੇਲ ਜੋਲਾਬ ਕਰਕੇ ਨਾ ਕਟ ਬ ਨਾ ਫੈਲੇ